ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਸੈਲਾਨੀ ਗਾਈਡ ਵਿਭਾਗ ਤੋਂ ਬੋਲ ਰਹੇ ਹੋ ਹਾਂਜੀ ਮੈਂ ਸਹਿਜਦੀਪ ਕੌਰ ਬੋਲ ਰਹੀ ਹਾਂ ਅਤੇ ਮੈਂ ਇੱਥੇ ਅੰਮ੍ਰਿਤਸਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਗਰਮੀਆਂ ਦੇ ਮਹਿਲ ਘੁੰਮਣ ਆਈ ਸੀ ਅਤੇ ਮੈਂ ਆਪ ਜੀ ਤੋਂ ਇਸ ਬਾਰੇ ਹੋਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਹੋਰ ਜਾਣਨਾ ਚਾਹੁੰਦੀ ਸੀ ਕਿ ਆਪ ਜੀ ਮੈਨੂੰ ਦੱਸ ਸਕਦੇ ਮੈ ਜਾਣਨਾ ਚਾਹੁੰਦੀ ਸੀ ਕਿ ਉਹਨਾਂ ਦਾ ਰਾਜ ਕਦੋਂ ਮਤਲਬ ਪੰਜਾਬ ਦੇ ਪੰਜਾਬ ਦਾ ਰਾਜ ਕਦੋਂ ਖਤਮ ਹੋਇਆ ਉਹਨਾਂ ਦਾ ਵਾਹ ਜੀ ਵਾਹ ਵਾਹ ਜੀ ਵਾਹ ਤੁਸੀਂ ਮੈਨੂੰ ਇਸ ਵਿਸ਼ੇ ਉੱਤੇ ਕੋਈ ਕਿਤਾਬਾਂ ਬਾਰੇ ਸੁਝਾਅ ਦੇ ਸਕਦੇ ਹੋ ਪੜ੍ਹਨ ਲਈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਮੈਨੂੰ ਹੋਰ ਇੱਕ ਇੱਕ ਕੋਈ ਵੀ ਸਥਾਨ ਜਿਹੜਾ ਘੁੰਮਣ ਲਈ ਅੰਮ੍ਰਿਤਸਰ ਦੱਸ ਸਕਦੇ ਹੋ ਮੈਂ ਸੁਣਿਆ ਇੱਕ ਭਾਈ ਵੀਰ ਸਿੰਘ ਜੀ ਦਾ ਵੀ ਘਰ ਹੈ ਇੱਥੇ ਇਹ ਉਹਨਾਂ ਦਾ ਅਸਲੀ ਘਰ ਹੀ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ